ਸੈਲਫ ਹੈਲਪ ਗਰੁੱਪ ਐੱਸ ਐੱਚ ਜੀ ਇੱਕ ਬਹੁਤ ਵਧੀਆ ਸਕੀਮ ਕਹਿ ਸਕਦੇ ਹਾਂ ਆਪਾਂ ਹੈਗੀ ਆ ਜਿਵੇਂ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਔਰਤਾਂ ਦੇ ਕੋਲ ਰੁਜ਼ਗਾਰ ਦੇ ਜ਼ਿਆਦਾ ਸਾਧਨ ਨਹੀਂ ਹੁੰਦੇ ਹੈਗੇ ਕਿਉਂ ਕਿਉਂਕਿ ਉਹ ਘਰਾਂ ਦੇ ਵਿੱਚੋਂ ਘਰਾਂ ਦੇ ਕੰਮਾਂ ਕਾਰਾਂ ਤੋਂ ਨਹੀਂ ਨਿਕਲ ਸਕਦੀਆਂ ਹੈਗੀਆਂ ਨੌ ਤੋਂ ਪੰਜ ਨਹੀਂ ਕੰਮ ਕਾਰ ਕਰ ਸਕਦੀਆਂ ਹੈਗੀਆਂ ਸੋ ਉਹਨਾਂ ਦੇ ਲਈ ਇਹ ਗਰੁੱਪ ਨੇ ਜਿਹੜੇ ਉਹ ਬਹੁਤ ਵਧੀਆ ਕਾਰਗਰ ਸਾਬਿਤ ਹੋਏ ਨੇ ਕਿਉਂਕਿ ਜਿਹੜੇ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਕੰਮ ਆਉਂਦੇ ਨੇ ਕਿਸੇ ਨੂੰ ਸਿਲਾਈ ਦਾ ਕੰਮ ਆਉਂਦਾ ਕਿਸੇ ਨੂੰ ਬੁਣਾਈ ਦਾ ਕੰਮ ਆਉਂਦਾ ਕਿਸੇ ਨੂੰ ਹੱਥੀਂ ਕਢਾਈ ਦਾ ਕੰਮ ਆਉਂਦਾ ਜਿਹਨੇ ਵੀ ਹੱਥੀਂ ਕੰਮ ਕਰ ਕਰਦੀਆਂ ਨੇ ਉਹ ਉਹਦੇ ਵਾਸਤੇ ਉਹਨਾਂ ਨੂੰ ਆ ਜਿਹੜਾ ਉਹਨਾਂ ਕੋਲ ਕਹਿ ਲਉ ਫੰਡਸ ਨਹੀਂ ਹੁੰਦੇ ਹੈਗੇ ਉਹਨਾਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਹੈਗੇ ਕਿ ਉਹ ਆਪਣਾ ਕਾ ਕਿੱਤਾ ਏ ਜਿਹੜਾ ਏ ਆਪਣਾ ਆਪ ਰੁਜ਼ਗਾਰ ਆਪਣਾ ਕੰਮ ਆ ਉਹ ਸ਼ੁਰੂ ਕਰ ਸਕਣ ਪਰ ਸੈਲਫ ਹੈਲਪ ਗਰੁੱਪ ਨੇ ਜਿਹੜੇ ਉਹ ਉਹਨਾਂ ਨੂੰ ਇਹ ਫਾਈਨੈਸ਼ੀਅਲ ਹੈਲਪ ਵੀ ਪ੍ਰੋਵਾਈਡ ਕਰਦੇ ਨੇ ਉਹਨਾਂ ਨੂੰ ਜੇ ਇੱਦਾਂ ਦੇ ਰੁਜ਼ਗਾਰਾਂ ਦੇ ਵਿੱਚ ਆਪਣੇ ਕਿੱਤਿਆਂ ਦੇ ਵਿੱਚ ਕੋਈ ਪ੍ਰੋਬਲਮਸ ਆ ਰਹੀਆਂ ਨੇ ਕਿ ਕਿਹੜਾ ਕੰਮ ਕਿਵੇਂ ਕੀਤਾ ਜਾਵੇਗਾ ਕਿੱਥੋਂ ਫੰਡਸ ਲੈ ਸਕਦੇ ਨੇ ਇਹਨਾਂ ਚੀਜ਼ਾਂ ਦੇ ਵਿੱਚੋਂ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਸੋ ਜਿੰਨੇ ਵੀ ਲੋਕ ਕਹਿ ਲਉ ਗਰੀਬ ਲੋਕ ਨੇ ਜਾਂ ਪੇਂਡੂ ਖੇਤਰ ਦੇ ਲੋਕ ਨੇ ਜਾਂ ਔਰਤਾਂ ਨੇ ਜਿਹਨਾਂ ਦੇ ਕੋਲ ਰੁਜ਼ਗਾਰ ਦੇ ਸਾਧਨ ਨਹੀਂ ਸੀਗੇ ਉਹਨਾਂ ਵਾਸਤੇ ਸੈਲਫ ਹੈਲਪ ਗਰੁੱਪ ਆ ਜਿਹੜਾ ਬਹੁਤ ਕਾਰਗਰ ਸਾਬਿਤ ਹੋਇਆ ਏ ਜਿਹਦੇ ਵਿੱਚ ਉਹਨਾਂ ਦੀਆਂ ਪ੍ਰੋਬਲਮਸ ਵੀ ਸੁਣੀਆ ਜਾਂਦੀਆਂ ਨੇ ਅਤੇ ਆਪਾਂ ਜੇ ਦੂਜੀ ਗੱਲ ਦੇਖੀਏ ਤਾਂ ਆਪਾਂ ਕਿਤੇ ਬੈਂਕਾਂ ਤੋਂ ਲੋਨ ਲੈਣਾ ਹੋਵੇ ਕੋਈ ਬਿਜ਼ਨਸ ਵਗੈਰਾ ਸ਼ੁਰੂ ਕਰਨ ਦੇ ਲਈ ਤਾਂ ਸਾਨੂੰ ਕੋਈ ਨਾ ਕੋਈ ਸਕਿਓਰਟੀ ਜਾਂ ਕੋਈ ਨਾ ਕੋਈ ਚੀਜ਼ ਗਿਰਵੀ ਰੱਖੀ ਰੱਖਣੀ ਪੈਂਦੀ ਹੈ ਜਾਂ ਕਹਿ ਲਓ ਆਪਾਂ ਨੂੰ ਬਹੁਤ ਜ਼ਿਆਦਾ ਵਿਆਜ ਦੇਣਾ ਪੈਂਦਾ ਸੋ ਹੈ ਸੈਲਫ ਹੈਲਪ ਗਰੁੱਪ ਨੇ ਜਿਹੜੇ ਇਹ ਪ੍ਰੋਬਲਮਸ ਵੀ ਜਿਹੜੀਆਂ ਦੂਰ ਕਰਦੀਆਂ ਨੇ ਕਿ ਬਿਨਾਂ ਕੋਰੈਟਰਲ ਤੋਂ ਬਿਨਾਂ ਸਕਿਓਰਟੀ ਤੋਂ ਆਪਾਂ ਘੱਟ ਵਿਆਜ ਦੇ ਉੱਤੇ ਜਿਹੜਾ ਆਪਣੇ ਲੋਨ ਲੈ ਸਕਦੇ ਹਾਂ ਆਪਣਾ ਰੁਜ਼ਗਾਰ ਦੇ ਸਾਧਨ ਆ ਜਿਹੜੇ ਉਹ ਬਣਾ ਸਕਦੇ ਹਾਂ ਸੋ ਔਰਤਾਂ ਦੇ ਲਈ ਮੈਨੂੰ ਲੱਗਦਾ ਬਹੁਤ ਵਧੀਆ ਮੌਕਾ ਇਹ ਕਿ ਸੈਲਫ ਹੈਪ ਹੈਲਪ ਗਰੁੱਪ ਦੇ ਨਾਲ ਜੁੜ ਕੇ ਉਹ ਆਪਣੇ ਰੁਜ਼ਗਾਰ ਦੇ ਸਾਧਨ ਆਪ ਬਣਾ ਸਕਦੇ ਹਨ